ਹੈਲੋ ਮੇਰਾ ਨਾਂ ਭਾਰਤ ਭੂਸ਼ਨ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਅਤੇ ਪਿਛਲੀ ਵਾਰ ਅਸੀਂ ਸ਼ਿਮਲਾ ਘੁੰਮਣ ਗਏ ਸੀ ਅਤੇ ਤੁਹਾਡੀ ਕੰਪਨੀ ਜਿਹਦਾ ਨਾਮ ਕਰਤਾਰ ਟਰੈਂਡਿੰਗ ਕਾਰ ਟਰੈਵਲਰ ਕੰਪਨੀ ਆ ਅਤੇ ਇਹਦੇ ਵਿੱਚੋਂ ਅਸੀਂ ਇੱਕ ਗੱਡੀ ਬੁੱਕ ਕਰਾਈ ਸੀ ਅਤੇ ਇਨੋਵਾ ਗੱਡੀ ਸੀ ਨੰਬਰ ਸ਼ਾਇਦ ਪੀ ਬੀ ਪੈਂਤੀ ਐਕਸ ਅਤੇ ਉਣਹੱਤਰ ਇਕਹੱਤਰ ਸੀ ਅਤੇ ਸਾਡੇ ਪਰਿਵਾਰ ਅਤੇ ਫੈਮਿਲੀ ਮੈਂਬਰ ਅਤੇ ਦੋਸਤਾਂ ਦਾ ਉਹ ਉਸ ਡਰਾਈਵਰ ਨਾਲ ਬਹੁਤ ਵਧੀਆ ਰਿਲੇਸ਼ਨ ਬਣ ਗਿਆ ਤੋਂ ਉਹ ਕਹਿੰਦੇ ਪਏ ਆ ਕਿ ਇਸ ਵਾਰ ਵੀ ਪਤਾ ਕਰੋ ਕਿ ਉਹ ਡਰਾਈਵਰ ਅੱਜ ਕੱਲ੍ਹ ਕਿੱਧਰ ਗੱਡੀ ਚਲਾ ਰਿਹਾ ਕਿਉਂਕਿ ਅਗਲੇ ਹਫਤੇ ਅਸੀਂ ਸ਼ਿ ਅਗਲੇ ਹਫਤੇ ਅਸੀਂ ਡਲਹੋਜੀ ਜਾਣਾ ਅਤੇ ਡਲਹੋਜੀ ਜਾਣ ਵਾਸਤੇ ਸਾਨੂੰ ਡਰਾਈਵਰ ਦੀ ਜ਼ਰੂਰਤ ਪੈਣੀ ਆ ਅਤੇ ਕਹਿੰਦੇ ਪਏ ਕਿ ਉਹ ਪਿਛਲੀ ਵਾਰ ਜਿਹੜਾ ਡਰਾਈਵਰ ਗਿਆ ਸੀ ਉਹ ਬਹੁਤ ਵਧੀਆ ਡਰਾਈਵ ਕਰਦਾ ਨਾਲੇ ਗੱਪਸ਼ੱਪ ਵੀ ਮਾਰਦਾ ਵਧੀਆ ਡਰਾਈਵ ਕਰਦਾ ਡਰਿੰਕ ਵਗੈਰਾ ਵੀ ਨਹੀਂ ਕਰਦਾ ਫੈਮਲੀ ਮੈਂਬਰ ਵਰਗਾ ਹੀ ਆ ਅਤੇ ਸੋਚਦੇ ਪਏ ਆ ਕਿ ਉਸੇ ਡਰਾਈਵਰ ਤੋਂ ਇਹ ਡਰਾਈਵ ਕਰਵਾਈ ਜਾਏ ਗੱਡੀ ਅਤੇ ਮੇਰਾ ਇਹੋ ਮੰਨਣਾ ਕਿ ਉਹ ਡਰਾਈਵਰ ਸ਼ਾਇਦ ਉਹਦਾ ਨਾਂ ਸੁਨੀਲ ਸੀ ਅਤੇ ਉਸ ਡਰਾਈਵਰ ਦਾ ਪਤਾ ਕਰਕੇ ਦੱਸੋ ਕਿ ਆਪਾਂ ਇੱਧਰ ਡਲਹੋਜੀ ਜਾਣਾ ਫੈਮਲੀ ਮੈਂਬਰ ਦਾ ਕਹਿਣਾ ਕਿ ਅਗਲੇ ਹਫਤੇ ਜਾਣਾ ਅਤੇ ਪਤਾ ਕਰਿਓ ਕਿ ਉਹ ਡਰਾਈਵਰ ਅੱਜ ਕੱਲ੍ਹ ਤੁਹਾਡੇ ਕੋਲ ਹੀ ਹੈ ਜਾਂ ਅੱਗੇ ਪਿੱਛੇ ਜੇ ਕਿਤੇ ਵੀ ਹੈਗਾ ਉਹਦਾ ਕੰਟੈਕਟ ਨੰਬਰ ਦੇ ਕੇ ਅਤੇ ਸਾਨੂੰ ਜ਼ਰੂਰ ਕੋਲ ਕਰੀਓ ਜੀ ਧੰਨਵਾਦ ਜੀ